ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਮਾਨਵ ਪਠਾਣੀਆ ਜਿੱਦਾਂ ਕਿ ਹੀ ਆਪ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਭਾਰਤ ਵਿੱਚ ਭੋਜਨ ਕਾਫੀ ਪ੍ਰਕਾਰ ਦੇ ਹਨ ਜਿੱਦਾਂ ਕਿ ਅਗਰ ਆਪਾਂ ਆਪਣੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਸਾਰਿਆਂ ਨੂੰ ਸਰਸੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਬਹੁਤ ਹੀ ਪਸੰਦ ਹੈ ਅਗਰ ਆਪਾਂ ਇੰਡੀਆ ਵਿੱਚ ਸਾਊਥ ਇੰਡੀਆ ਦੀ ਗੱਲ ਕਰ ਰਹੇ ਹਾਂ ਤਾਂ ਉਹਨਾਂ ਨੂੰ ਡੋਸਾ ਬਹੁਤ ਪਸੰਦ ਹੈ ਜਿਸ ਦੀ ਅੱਗੇ ਬਹੁਤ ਪ੍ਰਕਾਰਾਂ ਹਨ ਜਿੱਦਾਂ ਕਿ ਮਸਾਲਾ ਡੋਸਾ ਪਨੀਰ ਡੋਸਾ ਅਤੇ ਕਾਫੀ ਅਗਰ ਆਪਾਂ ਪੰਜਾਬ ਵਿੱਚ ਰੋਜ਼ਾਨਾ ਜੀਵਨ ਵਿੱਚ ਬਣਾਏ ਕੁਝ ਪ੍ਰਸਿੱਧ ਪਕਵਾਨ ਦੀ ਗੱਲ ਕਰੀਏ ਤਾਂ ਜਿੱਦਾਂ ਕਿ ਘਰਾਂ ਵਿੱਚ ਰਾਜਮਾਂਹ ਕਾਲੇ ਛੋਲੇ ਅੰਮ੍ਰਿਤਸਰੀ ਛੋਲੇ ਬਣਦੇ ਹਨ ਅਗਰ ਆਪਾਂ ਮਸਾਲਿਆਂ ਦੀ ਗੱਲ ਕਰੀਏ ਤਾਂ ਮਸਾਲੇ ਬਹੁਤ ਵੱਖ ਵੱਖ ਪ੍ਰਕਾਰ ਦੇ ਹੁੰਦੇ ਹਨ ਜੋ ਕਿ ਪਕਵਾਨ ਨੂੰ ਬਣਾਉਣ ਲਈ ਕਾਫੀ ਅਹਿਮੀਅਤ ਰੱਖਦੇ ਹਨ ਅਗਰ ਮੈਂ ਕੁਛ ਮਸਾਲਿਆਂ ਦੀ ਗੱਲ ਤ ਕਰਾਂ ਤਾਂ ਉਹ ਇਸ ਪ੍ਰਕਾਰ ਹਨ ਜਿੱਦਾਂ ਕਿ ਸੌਂਫ ਲੌਂਗ ਜੀਰਾ ਇਲਾਇਚੀ ਕਾਲੀ ਇਲਾਇਚੀ ਦਾਲਚੀਨੀ ਅਜਵਾਇਣ ਹਿੰਗ ਤੇਜ ਪੱਤਾ ਧਨੀਆ ਕੜੀ ਪੱਤਾ ਮੇਥੀ ਅੰਬਚੂਰ ਨਮਕ ਜੋ ਕਿ ਬਹੁਤ ਹੀ ਵੱਡਾ ਰੋਲ ਪਲੇਅ ਕਰਦਾ ਹੈ ਲਾਲ ਮਿਰਚ ਕਾਲੀ ਮਿਰਚ ਹਲਦੀ ਮੁਲੱਠੀ ਸੁੰਡ ਜਵੱਤਰੀ ਅਤੇ ਕਾਫੀ ਪ੍ਰਕਾਰ ਦੇ ਮਸਾਲੇ ਹਨ ਜੋ ਕਿ ਸਾਡੇ ਪਕਵਾਨ ਨੂੰ ਸੁਆਦਿਸ਼ਟ ਬਣਾਉਂਦੇ ਹਨ ਧੰਨਵਾਦ